ਖੇਡਾਂ ਦੇ ਪੱਧਰ ਦੇ ਵਿੱਚ ਇਹ ਆ ਕਿ ਵੀ ਜਿਹੜੀਆਂ ਸਾਨੂੰ ਖੇਤਰ ਪੱਧਰ 'ਤੇ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਵੀ ਸਾਡੇ ਪਿੰਡ ਦੇ ਵਿੱਚ ਵੀ ਐਨ ਆਰ ਆਈ ਭਾਈਚਾਰਾ ਰਲ ਕੇ ਵੀ ਜਿਹੜੇ ਬਾਹਰ ਬੈਠੇ ਹੁੰਦੇ ਉਹ ਇੱਥੇ ਪੈਸਾ ਭੇਜਦੇ ਆ ਬੰਦਿਆਂ ਦੇ ਹੱਥ 'ਚ ਵੀ ਉਹ ਟੂਰਨਾਮੈਂਟ ਕਰਵਾਉਂਦੇ ਜਿਵੇਂ ਕਿ ਸਾਡੇ ਕਬੱਡੀ ਕੱਪ ਹੁੰਦੇ ਆ ਕ੍ਰਿਕੇਟ ਦੇ ਮੈਚ ਵਗੈਰਾ ਹੁੰਦੇ ਆ ਅਤੇ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਉਹਦੇ ਵਿੱਚ ਇਹ ਹੁੰਦਾ ਕਿ ਉਹ ਉਹਨਾਂ ਨੂੰ ਵੀ ਵੱਡੇ ਵੱਡੇ ਵਰਲਡ ਕੱਪ ਦਿੱਤੇ ਜਾਂਦੇ ਆ ਗੋਲਡ ਮੈਡਲ ਦਿੱਤੇ ਜਾਂਦੇ ਜਿਹਦੇ ਵਿੱਚ ਵੀ ਗੋਲਡ ਮੈਡਲ ਦੇ ਵਿੱਚ ਵੀ ਕੁਛ ਧਾਤ ਸੋਨਾ ਮਿਲਿਆ ਹੁੰਦਾ ਅਤੇ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਲੱਖ ਇਨਾਮ ਦਿੱਤੇ ਜਾਂਦੇ ਜਿਵੇਂ ਬੈਸਟ ਜਾਫਰ ਹੋ ਗਿਆ ਬੈਸਟ ਰੇਡਰ ਹੋ ਗਿਆ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਆ ਇਸ ਤੋਂ ਇਲਾਵਾ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਜਿਵੇਂ ਕਿ ਵੀ ਉਹ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਪੱਧਰ 'ਤੇ ਹੋਰ ਖਿਡਾਰੀ ਅੱਗੇ ਦੇ ਅੱਗੇ ਜਾਂਦਾ ਤਾਂ ਉਹਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਅਤੇ ਜਿਹੜਾ ਨੀਵਾਂ ਪੱਧਰ ਆ ਉਹਦੇ ਪੱਧਰ 'ਤੇ ਵੀ ਸਰਕਾਰ ਵੱਲੋਂ ਜਿਵੇਂ ਕਿ ਸਾਡੇ ਏ ਪੇਂਡੂ ਖੇਤਰ ਦੇ ਏਰੀਏ ਵਿੱਚ ਗਰਾਊਂਡ ਮੁਹੱਈਆ ਕਰਵਾਏ ਜਾਂਦੇ ਆ ਅਤੇ ਗਰਾਉਂਡ ਦੇ ਵਿੱਚ ਹੀ ਇੱਕ ਫਰੀ ਜਿੰਮ ਮੁਹੱਈਆ ਕਰਵਾਈ ਜਾਂਦੀ ਆ ਜਿੰਮ ਦੇ ਵਿੱਚ ਵੀ ਸਾਰੇ ਜਿੰਨਾ ਵੀ ਸਾਰਾ ਜਿੰਮ ਦਾ ਸਮਾਨ ਹੁੰਦਾ ਡੰਬਲ ਵਗੈਰਾ ਉਹ ਪ੍ਰੋਵਾਈਡ ਕਰਵਾਏ ਜਾਂਦੇ ਆ ਵੀ ਉਹਦੀ ਵੀ ਚਾਬੀ ਇੱਕ ਕਿਸੇ ਖਾਸ ਬੰਦੇ ਕੋਲ ਹੁੰਦੀ ਆ ਵੀ ਉਹ ਲੈ ਲੈਂਦੇ ਆ ਨਹੀਂ ਤਾਂ ਹਰ ਇੱਕ ਬੰਦੇ ਕੋਲ ਇੱਕ ਨਾ ਇੱਕ ਕੋਈ ਨਾ ਕੋਈ ਚਾਬੀ ਹੁੰਦੀ ਆ ਅਤੇ ਉਸ ਤੋਂ ਬਾਅਦ ਵੀ ਜਿਹੜੀ ਆ ਸਰਕਾਰ ਆ ਜਿਵੇਂ ਸਪੋਰਟਸ ਕੋਟੇ 'ਚ ਕੋਈ ਬੱਚਾ ਕੰਮ ਕਰ ਰਿਹਾ ਉਹਨੂੰ ਸ਼ੂਜ ਦੇ ਤੇ ਜਿਵੇਂ ਸਟੱਡ ਕਹਿ ਦਿੰਦੇ ਆ ਆਪਾਂ ਲੋਅਰਾਂ ਟੀ ਸ਼ਰਟ ਦੇ ਤੀਆਂ ਹੋਰ ਕੋਈ ਖੇਡਣ ਦੀ ਸਮੱਗਰੀ ਦੇ ਤੀ ਕੋਈ ਟੇਬਲ ਟੈਨਿਸ ਖੇਡ ਰਿਹਾ ਉਹਨੂੰ ਉਹਦੇ ਨਾਲ ਸੰਬੰਧਿਤ ਸਮੱਗਰੀ ਦੇ ਤੀ ਅਤੇ ਬਸ ਇਹ ਖੇਡਾਂ ਦੇ ਖੇਤਰ ਵਿੱਚ